ਪਰਿਵਾਰ ਦਾ ਕੋਈ ਵੀ ਮੈਂਬਰ ਹੋਵੇ ਖਾਣਾ ਬਣਾਉਣ ਦੇ ਸਮੇਂ ਹਰ ਇੱਕ ਦੀ ਸਿਹਤ ਦਾ ਖਿਆਲ ਰੱਖਦਾ ਹੈ ਚਾਹੁੰਦਾ ਹੈ ਪੋਸ਼ਨ ਭਰਪੂਰ ਖਾਨਾ ਹੀ ਘਰ ਵਿੱਚ ਤਿਆਰ ਕਰਨਾ ਚਾਹੁੰਦਾ ਹੈ ਇੱਕ ਬੈਲਂਸ ਡਾਈਟ ਚਾਰਟ ਜ਼ਰੂਰ ਬਣਾਉਣਾ ਚਾਹੀਦਾ ਹੈ ਜਿਸ ਵਿੱਚ ਹਰ ਇੱਕ ਮੈਂਬਰ ਸਿਹਤ ਵਜੋਂ ਠੀਕ ਰਹਿਣ ਖਾਣਾ ਬਣਾਉਂਦੇ ਸਮੇਂ ਜੇ ਹੋ ਸਕੇ ਤਾਂ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਜਾਣਾ ਚਾਹੀਦਾ ਹੈ ਜੈਸੇ ਕਿ ਕਹਾਵਤ ਬਣੀ ਹੋਈ ਹੈ ਨਾ ਜੈਸਾ ਖਾਇ ਅਨ ਵੈਸਾ ਬਣੇ ਮਨ ਇਸ ਲਈ ਖਾਣਾ ਸਾਫ਼ ਸੁਥਰਾ ਔਰ ਪਰਮ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਹੀ ਬਣਾਉਣਾ ਚਾਹੀਦਾ ਹੈ